ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਕੌਣ ਨਹੀਂ ਨਹੀਂ ਦੱਸੋ ਕੌਣ ਤੁਸੀਂ ਅੱਛਾ ਜੀ ਜਿਹੜੇ ਤੁਸੀਂ ਨਵੇਂ ਆਏ ਹੋ ਸਾਡੇ ਗੁਆਂਢ ਵਿੱਚ ਹਾਂਜੀ ਹਾਂਜੀ ਦੇਖ ਲਿਆ ਪਹਿਚਾਣ ਲਿਆ ਹੋਰ ਸੁਣਾਓ ਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਮੈਮ ਹਾਂਜੀ ਹਾਂਜੀ ਨਹੀਂ ਮੰਡੀ ਤਾਂ ਮੈਮ ਸਾਰੇ ਪਾਸੇ ਆ ਅਤੇ ਆਪਣੇ ਜਿੱਦਾਂ ਬਲਾਚੌਰ ਹੋ ਗਿਆ ਹਾਂਜੀ ਨਵਾਂਸ਼ਹਿਰ ਹੋ ਗਿਆ ਨਵਾਂਸ਼ਹਿਰ ਤਾਂ ਥਾਂ ਥਾਂ 'ਤੇ ਮੰਡੀਆਂ ਅਤੇ ਹਾਂਜੀ ਉਥੋਂ ਦੀ ਜਿਹੜੀ ਸਬਜ਼ੀ ਆ ਉਹਦੀ ਕੋਆਲਟੀ ਵੀ ਵਧੀਆ ਹੈ ਆ ਹਾਂਜੀ ਹਾਂਜੀ ਹਾਂਜੀ ਅਸੀਂ ਤਾਂ ਕਦੋਂ ਤੋਂ ਇੱਥੇ ਹੀ ਆ ਹਾਂਜੀ ਅਤੇ ਤੁਸੀਂ ਫਿਰ ਇੱਦਾਂ ਕਰਿਓ ਬਲਾਚੌਰ ਮੰਡੀ ਆ ਦਾਣਾ ਮੰਡੀ ਅਤੇ ਨਾਲ ਨਾਲ ਵਾਲੀ ਸਾਈਡ ਹੈ ਆ ਜਿੱਦਾਂ ਸਬਜ਼ੀ ਮੰਡੀ ਹਾਂਜੀ ਉਥੋਂ ਦੀ ਸਬ ਸਬਜ਼ੀ ਸਬਜ਼ੀਆਂ ਬਹੁਤ ਮਸ਼ਹੂਰ ਆ ਥਾਂ ਥਾਂ ਤੋਂ ਲੋਕ ਦੂਰ ਦੂਰ ਤੋਂ ਆਉਂਦੇ ਆ ਜਿੱਦਾਂ ਨਵਾਂਸ਼ਹਿਰ ਸਬਜ਼ੀ ਮੰਡੀ ਵੀ ਬਹੁਤ ਵੱਡੀ ਆ ਹਾਂਜੀ ਬੇਸ਼ੱਕ ਤੁਸੀਂ ਉਥੋਂ ਖ਼ਰੀਦ ਲਿਆਇਓ ਲਿਆਇਓ ਹਾਂਜੀ ਕੋਆਲਟੀ ਵਧੀਆ ਹੈ ਵੈਸੇ ਨਹੀਂ ਨਹੀਂ ਤਾਜ਼ੀਆਂ ਸਬਜ਼ੀਆਂ ਆਉਂਦੀਆਂ ਹੈ ਜਿੱਦਾਂ ਡੇਲੀ ਰੋਜ਼ ਨਵੀਂ ਤਾਜ਼ਾ ਸ ਸਬਜ਼ੀ ਤੋੜਦੇ ਆ ਸਾਰੇ ਅਤੇ ਉੱਥੇ ਫਿਰ ਉੱਥੇ ਆਉਂਦੀਆਂ ਸਬਜ਼ੀਆਂ ਸਬਜ਼ੀਆਂ ਹਰੀਆਂ ਸਾਰੀਆਂ ਜਿੱਦਾਂ ਤੋਰੀ ਹੋ ਗਈ ਗਾਜਰ ਹੋ ਗਈ ਭਿੰਡੀ ਹੋ ਗਈ ਕਰੇਲੇ ਹੋ ਗਏ ਹੈ ਨਾ ਅਤੇ ਹਾਂਜੀ ਇਹ ਵਾਲੀ ਸਬਜ਼ੀਆਂ ਹੁੰਦੀਆਂ ਹੈ ਅਤੇ ਤੁਸੀਂ ਲੈਣਾ ਚਾਹੁੰਗੇ ਹਾਂਜੀ ਕੋਈ ਨਹੀਂ ਤੁਸੀਂ ਉਥੋਂ ਖ਼ਰੀਦ ਲਿਓ ਵਧੀਆ ਹੈ ਨਾ ਠੀਕ ਹੈ ਓਕੇ ਠੀਕ ਠੀਕ ਠੀਕ